ਪੇਂਡੂ ਖੇਤਰਾਂ ਵਿੱਚ ਜੋ ਮੁੱਖ ਘਾਟ ਹੈ ਉਹ ਹੈ ਸਿਹਤ ਵਿਭਾਗ ਵਿੱਚ ਜਿਵੇਂ ਕਿ ਪਿੰਡਾਂ ਵਿੱਚ ਦੇਖਿਆ ਜਾਂਦਾ ਹੈ ਮੁੱਖ ਸੇਵਾਵਾਂ ਜੋ ਵਾਂਝੇ ਰਹਿ ਜਾਂਦੇ ਨੇ ਲੋਕ ਉਹ ਨੇ ਸਿਹਤ ਵਿਭਾਗ ਵਿੱਚ ਜਿਵੇਂ ਸ ਸਿਹਤ ਸੰਬੰਧੀ ਜਿਵੇਂ ਆਪਾਂ ਕਹਿ ਲਉ ਹੋਸਪਿਟਲ ਵਧੀਆ ਹੋਣ ਤਾਂ ਜੋ ਲੋਕਾਂ ਨੂੰ ਚੰਗੀ ਤਰ੍ਹਾਂ ਫਸਿਲਟੀਜ਼ ਦੇ ਸਕਣ ਇਹ ਘਾਟ ਰਹਿ ਜਾਂਦੀ ਹੈ